ਪੰਜਾਬ ਵਿੱਚ ਅਭਿਆਸ ਕੀਤੇ ਗਏ ਵੱਖ ਵੱਖ ਧਰਮ ਅਧਿਆਤਮਿਕ ਜਾਂ ਵਿਅਕਤੀਗਤ ਵਿਕਾਸ ਦੇ ਮੁੱਦੇ ਨੂੰ ਕੁਝ ਇਸ ਤਰ੍ਹਾਂ ਸੰਬੋਧਿਤ ਕੀਤਾ ਗਿਆ ਹੈ ਜਿਵੇਂ ਕਿ ਪੰਜਾਬ ਵਿੱਚ ਸਿੱਖ ਧਰਮ ਨੂੰ ਲੈ ਕੇ ਜੇਕਰ ਗੱਲ ਕੀਤੀ ਜਾਵੇ ਤਾਂ ਆਪਾਂ ਗੁਰਬਾਣੀ ਵਿੱਚੋਂ ਸਿੱਖਦੇ ਹਾਂ ਕੀ ਆਪਾਂ ਸਾਪਾਂ ਨੂੰ ਸਭ ਨੂੰ ਇਕੁਲ ਲੈ ਕੇ ਚੱਲਣਾ ਚਾਹੀਦਾ ਕਿਸੇ ਨਾਲ ਵੀ ਕੋਈ ਭੇਦਭਾਵ ਨਹੀਂ ਕਰਨਾ ਚਾਹੀਦਾ ਠੀਕ ਹੈ ਕੋਈ ਨੀਵਾਂ ਕੋਈ ਉੱਚਾ ਨਹੀਂ ਇਹ ਤੋਂ ਆਪਾਂ ਕਾਫੀ ਕੁਝ ਸਹੀ ਸਿੱਖਦੇ ਹਾਂ ਅਤੇ ਉਹਨੂੰ ਆਪਾਂ ਜੇਕਰ ਆਪਣੇ ਰੀਅਲ ਲਾਈਫ ਵਿੱਚ ਇੰਪਲੀਮੈਂਟ ਕਰਦੇ ਹਾਂ ਅਤੇ ਆਪਾਂ ਇੱਕ ਚੰਗੇ ਨਾਗਰਿਕ ਬਣਦੇ ਹਾਂ ਜੇਕਰ ਆਪਾਂ ਚੰਗੇ ਨਾਗਰਿਕ ਬਣਦੇ ਹਾਂ ਤਾਂ ਆਪਾਂ ਰੱਜ ਦੇ ਨਾਲ ਨਾਲ ਆਪਣੀ ਵੀ ਮਤਲਬ ਬੜੋਤਰੀ ਕਰਦੇ ਮਤਲਬ ਸਾਡਾ ਵੀ ਨਾਮ ਹੁੰਦਾ ਕਿ ਹਾਂ ਯਾਰ ਇਹ ਬੰਦੇ ਨੇ ਚੰਗੀ ਚੀਜ਼ਾਂ ਸਿੱਖੀਆਂ ਵਾਂ ਫਿਰ ਲੋਕ ਪੁੱਛਦੇ ਨੇ ਹਾਂ ਯਾਰ ਤੇਰੇ ਜੀਵਨ ਵਿੱਚ ਜੇ ਆਹ ਚੰਗੀ ਚੀਜ਼ ਆਈ ਤਾਂ ਕਿੱਥੋਂ ਆਈ ਹੈ ਫਿਰ ਆਪਾਂ ਉਹਨਾਂ ਨੂੰ ਦੱਸਦੇ ਹਾਂ ਯਾਰ ਆਪਾਂ ਇਹ ਗ੍ਰੰਥ ਪੜ੍ਹਿਆ ਅਤੇ ਇਹ ਚੀਜ਼ਾਂ ਆਪਾਂ ਪੜ੍ਹੀਆਂ ਤਾਂ ਕਰਕੇ ਆਪਾਂ ਇਹਨਾਂ ਨੂੰ ਆਪਣੇ ਜੀਵਨ ਵਿੱਚ ਉਤਾਰ ਰਹੇ ਹਾਂ ਅਤੇ ਜੇਕਰ ਆਪਾਂ ਗ੍ਰੰਥ ਪੜ੍ਹ ਰਹੇ ਹਾਂ ਤਾਂ ਆਪਾਂ ਸਹੀ ਤਰੀਕੇ ਨਾਲ ਪੜ੍ਹੀਏ ਉਹਦੀ ਆਪਾਂ ਚੰਗੀ ਤਰ੍ਹਾਂ ਮਤਲਬ ਆਪਾਂ ਉਹਨੂੰ ਪੋਜਟਿਵ ਵਿੱਚ ਲਈਏ ਇਹ ਨਹੀਂ ਕਿ ਗ੍ਰੰਥ ਪੜ੍ਹ ਰਹੇ ਹਾਂ ਅਤੇ ਹੰਕਾਰ ਆ ਜਾਵੇ ਨਹੀਂ ਯਾਰ ਮੈਂ ਆਹ ਗ੍ਰੰਥ ਪੜ੍ਹਿਆ ਅਤੇ ਮੈਂ ਮੈਨੂੰ ਨਹੀਂ ਪਤਾ ਮੈਂ ਕਿਸੇ ਦੀ ਨਹੀਂ ਮੰਨਣੀ ਇਹ ਇਹ ਚੀਜ਼ ਨਹੀਂ ਬੰਦੇ 'ਚ ਹੋਣੀ ਚਾਹੀਦੀ ਬੰਦੇ 'ਚ ਇਹ ਚੀਜ਼ ਹੋਣੀ ਚਾਹੀਦੀ ਕਿ ਸਭ ਨੂੰ ਇਕੁਅਲ ਲੈ ਕੇ ਚੱਲੇ ਅਤੇ ਆਪਣੇ ਅੰਦਰ ਉਹਦੇ ਵਧੀਆ ਸਤਿਕਾਰ ਹੋਵੇ ਵੱਡਿਆਂ ਨੂੰ ਲੈ ਕੇ ਸਤਿਕਾਰ ਕਰੇ ਛੋਟਿਆਂ ਨੂੰ ਵੀ ਸਤਿਕਾਰ ਕਰੇ ਜੀ ਜੀ ਕਰਕੇ ਸਾਰਿਆਂ ਨੂੰ ਬੁਲਾਵੇ ਠੀਕ ਆ ਨਾ ਅਤੇ ਇਸ ਤਰ੍ਹਾਂ ਸਾਨੂੰ ਆਪਣੇ ਜੀਵਨ ਵਿੱਚ ਗ੍ਰੰਥਾਂ ਨੂੰ ਉਧਾਰਕ ਉਧਾਰਨਾ ਚਾਹੀਦਾ ਹੈ